ਪੰਜਾਬੀ ਭਾਸ਼ਾ ਜਿਹਨੂੰ ਕਿ ਅਸੀਂ ਪੰਜਾਬੀ ਦੇ ਵਿੱਚ ਮਾਂ ਬੋਲੀ ਕਹਿੰਦੇ ਹਨ ਮੈਨੂੰ ਮਾਣ ਹੈ ਕਿ ਮੈਂ ਪੰਜਾਬ ਦੇ ਵਿੱਚ ਜਨਮ ਲਿਆ ਹੈ ਅਤੇ ਮੈਨੂੰ ਮਾਂ ਬੋਲੀ ਬੋਲਣ ਦਾ ਮੌਕਾ ਮਿਲਿਆ ਹੈ ਪੰਜਾਬੀ ਪੰਜਾਬੀ ਬੋਲੀ ਸਾਡੀ ਅਜਿਹੀ ਬੋਲੀ ਹੈ ਜਿਹੜੀ ਕਿ ਨਾ ਕਿ ਪੰਜਾਬ ਦੇ ਵਿੱਚ ਹੀ ਮਸ਼ਹੂਰ ਹੈ ਬੋਲੀ ਜਾਂਦੀ ਹੈ ਬਲਕਿ ਹੁਣ ਇਹ ਪੰਜਾਬੀ ਬੋਲੀ ਸਾਡੀ ਪੰਜਾਬ ਦੇ ਜਿਹੜੇ ਨੌਜਵਾਨ ਬਾਹਰ ਜਾ ਕੇ ਵਸੇ ਨੇ ਬਾਹਰ ਪੰਜਾਬੀ ਬੋਲਦੇ ਨੇ ਗਾਉਂਦੇ ਨੇ ਪੰਜਾਬੀ ਗਾਣੇ ਪੰਜਾਬੀ ਮਾਂ ਬੋਲੀ ਭਾਸ਼ਾ ਨਾਲ ਗੱਲਾਂ ਕਰਦੇ ਨੇ ਇਹ ਬੋਲੀ ਸਾਡੀ ਮਾਂ ਮਾਂ ਬੋਲੀ ਜਿਹੜੀ ਭਾਸ਼ਾ ਇਹ ਕਹਿੰਦੇ ਨੇ ਇਹ ਬਾਹਰ ਦੇ ਮੁਲਕਾਂ ਤੱਕ ਵੀ ਪ੍ਰਚਲਿਤ ਹੋ ਚੁੱਕੀ ਹੈ ਮੈਨੂੰ ਮਾਣ ਹੈ ਕਿ ਮੈ ਪੰਜਾਬ ਵਿੱਚ ਮੇਰਾ ਜਨਮ ਹੋਇਆ ਹੈ

ਸਾਡੇ ਪੰਜਾਬ ਵਿੱਚ ਜਦੋਂ ਕਿਤੇ ਵੀ ਕੋਈ ਸੱਭਿਆਚਾਰਕ ਮੇਲਾ ਲੱਗਦਾ ਹੈ ਸੱਭਿਆਚਾਰਕ ਕੋਈ ਵੀ ਕਿਤੇ ਕਿਸੇ ਕਿਸਮ ਦਾ ਭੰਗੜਾ ਲੱਗਦਾ ਹੈ ਗਿੱਧਾ ਲੱਗਦਾ ਹੈ ਤੀਆਂ ਲੱਗਦੀਆਂ ਨੇ ਜਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਲਾ ਲਓ ਜਿਹੜੇ ਸਾਡੇ ਸੱਭਿਆਚਾਰਕ ਵਿੱਚ ਆਉਂਦੇ ਨੇ ਅਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਸ਼ ਵਿਦੇਸ਼ ਦੇ ਲੋਕ ਵੀ ਅੱਡੀਆਂ ਚੁੱਕ ਚੁੱਕ ਕੇ ਦੇਖਦੇ ਨੇ ਕਿਉਂਕਿ ਇੱਕ ਪੰਜਾਬ ਹੀ ਇੱਕ ਐਸਾ ਹੈ ਰਾਜ ਹੈ ਪ੍ਰਾਂਤ ਹੈ ਜਿਹੜਾ ਕਿ ਬਾਕੀ ਭਾਸ਼ਾਵਾਂ ਭਾਸ਼ਾਵਾਂ ਬੋਲਣ ਦੇ ਵਾਲੇ ਲੋਕਾਂ ਦੇ ਨਾਲੋਂ ਉੱਪਰ ਹੈ ਮੈਨੂੰ ਖੁਸ਼ੀ ਹੈ ਕਿ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਪੰਜਾਬੀ ਭਾਸ਼ਾ ਸਾਡੇ ਮੁਲਕ ਵਿੱਚ ਅਜਿਹੀ ਭਾਸ਼ਾ ਹੈ ਜਿਹੜੀ ਕਿ ਕਿਸੇ ਨੂੰ ਬੋਲਣ ਵਿੱਚ ਕੋਈ ਹਿਚਹਿਚਾਹਕ ਨਹੀਂ ਹੁੰਦੀ ਸ਼ਰਮ ਨਹੀਂ ਹੁੰਦੀ ਤਾਂ ਮੈਂ ਹਰ ਇੱਕ ਮਹਿਕਮੇ ਵਿੱਚ ਜਾਵਾਂ ਅਤੇ ਮੈਂ ਅੰਗਰੇਜ਼ੀ ਬੋਲਣਾ ਨਹੀਂ ਬਲਕਿ ਆਪਣੀ ਮਾਂ ਬੋਲੀ ਭਾਸ਼ਾ ਪੰਜਾਬੀ ਬੋਲਣਾ ਹੀ ਪਸੰਦ ਕਰਾਂਗੀ ਕਿਉਂਕਿ ਮੈਨੂੰ ਮਾਣ ਹੈ ਕਿ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਅਤੇ ਮੈਨੂੰ ਮਾਂ ਬੋਲੀ ਭਾਸ਼ਾ ਬੋਲਣ ਦਾ ਮੌਕਾ ਮਿਲਿਆ ਇੱਥੋਂ ਤੱਕ ਕਿ ਮੈਂ ਆਪਣੇ ਬੱਚਿਆਂ ਨੂੰ ਵਧੀਆ ਸਕੂਲੇ ਪੜ੍ਹਾ ਕੇ ਵੀ ਸਟੈਂਡ ਕਰਾ ਕੇ ਵੀ ਉਹਨਾਂ ਦੇ ਨਾਲ ਪੰਜਾਬੀ ਵਿੱਚ ਹੀ ਗੱਲ ਕਰਦੀ ਹਾਂ ਅਤੇ ਉਹਨਾਂ ਨੂੰ ਵੀ ਇਹ ਹਦਾਇਤ ਦਿੰਦੀ ਹਾਂ ਕਿ ਕਿਸੇ ਵੀ ਸਰਕਾਰੀ ਦਫਤਰ ਵਿੱਚ ਜਾਓ ਕਿਸੇ ਵੀ ਮਹਿਕਮੇ ਵਿੱਚ ਜਾਓ ਜਾਂ ਕਿੰਨੇ ਵੀ ਪੜ੍ਹੇ ਲਿਖੇ ਬੰਦੇ ਨਾਲ ਗੱਲ ਕਰੋ ਅਤੇ ਹਮੇਸ਼ਾ ਹੀ ਆਪਣੀ ਮਾਂ ਬੋਲੀ ਭਾਸ਼ਾ ਦੀ ਹੀ ਵਰਤੋਂ ਕਰੋ ਕਿਉਂਕਿ ਜਿੱਥੋਂ ਤੱਕ ਸਾਨੂੰ ਇਹੀ ਮਾਂ ਬੋਲੀ ਤੋਂ ਹੀ ਸਾਨੂੰ ਪਹਿਛਾਣ ਹੈ ਸਾਨੂੰ ਲੋਕ ਜਾਣਦੇ ਨੇ ਕਿ ਇਹ ਪੰਜਾਬ ਦੇ ਰਹਿਣ ਵਾਲੇ ਨੇ ਇਹ ਪੰਜਾਬੀ ਹੈ ਇਸ ਕਰਕੇ ਸਾਨੂੰ ਆਪਣੀ ਪੰਜਾਬੀ ਭਾਸ਼ਾ ਨੂੰ ਛੱਡ ਕੇ ਅੰਗਰੇਜ਼ੀ ਭਾਸ਼ਾ ਨੂੰ ਨਹੀਂ ਅਪਣਾਉਣਾ ਚਾਹੀਦਾ ਪੰਜਾਬੀ ਭਾਸ਼ਾ ਉਹ ਹੈ ਜਿਹੜੀ ਅਸੀਂ ਜਨਮ ਤੋਂ ਤੁਰੰਤ ਉਪ੍ਰਾਨ ਆਪਣੀ ਮਾਂ ਤੋਂ ਸਿੱਖਦੇ ਹਾਂ ਇਹ ਸਾਡੀ ਮਾਂ ਬੋਲੀ ਭਾਸ਼ਾ ਹੈ ਅਸੀਂ ਆਪਣੀ ਮਾਂ ਬੋਲੀ ਭਾਸ਼ਾ ਨੂੰ ਪਿੱਛੇ ਰੱਖ ਕੇ ਦੂਸਰੀ ਭਾਸ਼ਾ ਨੂੰ ਕਿਵੇਂ ਅੱਗੇ ਕਰ ਸਕਦੇ ਹਾਂ ਇਸ ਕਰਕੇ ਮੈਨੂੰ ਮਾਣ ਹੈ ਕਿ ਮੈਂ ਪੰਜਾਬ ਦੀ ਵਾਸੀ ਹਾਂ ਅਤੇ ਮੈਂ ਪੰਜਾਬਣ ਹਾਂ